ਭਾਰਤ ਦੀ ਰਾਜਨੀਤੀ ਪਾਰਟੀਆਂ ਬਾਰੇ ਬਹੁਤਾ ਜ਼ਿਆਦਾ ਮੈਂ ਗਿਆਨ ਨਹੀਂ ਰੱਖਦਾ ਪਰ ਮੇਰਾ ਜੋ ਪਸੰਦੀਦਾ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਅਤੇ ਮੈਂ ਇਸ ਕਰਕੇ ਉਹਨਾਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਜੋ ਦੇਸ਼ ਦੇ ਵਿੱਚ ਭੇਦਭਾਵ ਔਰ ਜਾਤੀਵਾਦ ਇਸ ਦੇ ਉੱਪਰ ਤੁਸੀਂ ਕਦੋਂ ਕੰਮ ਕਰੋਗੇ ਕਦੋਂ ਇਹਨਾਂ ਨੂੰ ਖਤਮ ਕਰੋਗੇ